ਪੰਜਾਬੀ ਭਾਸ਼ਾ ਦੀ ਸਭ ਤੋਂ ਇੰਪੋਟੈਂਟ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਸੀਂ ਆਪਣੇ ਹਾਵ ਭਾਵ ਆਪਣੇ ਮਨ ਦੇ ਵਲਵਲੇ ਵੱਟਾ ਨੂੰ ਪੂਰੀ ਡਿਟੇਲ 'ਚ ਐਕਸਪਲੇਨ ਕਰ ਸਕਦੇ ਐਂ ਇਹਦੇ ਵਿੱਚ ਸਾਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਹੈਗੀ ਕਿ ਅਸੀਂ ਆਪਣੇ ਆਪਣੀਆਂ ਗੱਲਾਂ ਨੂੰ ਦੂਜੇ ਸਾਹਮਣੇ ਕਿੱਦਾਂ ਰੱਖੀਏ ਕਿਉਂਕਿ ਪੰਜਾਬੀ ਭਾਸ਼ਾ ਸਾਡੀ ਮਦਰ ਲੈਂਗੁਏਜ ਹੈ ਇਹਨੂੰ ਅਸੀਂ ਬਚਪਨ ਤੋਂ ਹੀ ਆਪਣੇ ਘਰ ਤੋਂ ਹੀ ਸਿੱਖਦੇ ਐਂ ਅਸੀਂ ਸਟਾਟਿੰਗ ਜਦੋਂ ਘਰ ਵਿੱਚ ਬੋਲਣਾ ਸ਼ੁਰੂ ਕਰਦੇ ਹਾਂ ਉਦੋਂ ਪੰਜਾਬੀ ਤੋਂ ਹੀ ਕਰਦੇ ਐਂ ਇਸ ਲਈ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਅਦਰ ਲੈਂਗੁਏਜ ਅਸੀਂ ਸਿੱਖਦੇ ਐਂ ਪੰਜਾਬੀ ਲੈਂਗੁਏਜ ਨੂੰ ਸਿੱਖਣ ਲਈ ਸਾਨੂੰ ਜਿਆਦਾ ਆਪਣੇ ਦਿਮਾਗ 'ਤੇ ਜ਼ੋਰ ਨਹੀਂ ਪਾਉਣਾ ਪੈਂਦਾ ਕਿਉਂਕਿ ਇਹ ਲੈਂਗੁਏਜ ਇੱਦਾਂ ਦੀ ਹੈ ਜਿਹਨੂੰ ਅਸੀਂ ਆਪਣੇ ਘਰ ਤੋਂ ਹੀ ਸਿੱਖਦੇ ਐਂ